ਪੰਜਾਬ ਵਿੱਚ ਅੱਜ ਕੱਲ੍ਹ ਦੀ ਗਾਇਕੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਗਲਤਾਨ ਹੋ ਚੁੱਕੀ ਹੈ ਜ਼ ਜ਼ਿਆਦਾਤਰ ਜਿਹੜੇ ਅੱਜ ਕੱਲ੍ਹ ਦੇ ਗਾਇਕ ਹੈ ਉਹ ਹਥਿਆਰਾਂ 'ਤੇ ਨਸ਼ਿਆਂ 'ਤੇ ਜ਼ਿਆਦਾਤਰ ਗੀਤ ਲਿਖਦੇ ਹੈ ਅਤੇ ਉਹ ਗਾਉਂਦੇ ਹੈ ਜਿਸ ਨਾਲ ਅੱਜ ਕੱਲ੍ਹ ਦਾ ਜਿਵੇਂ ਬੱਚਾ ਬੱਚਾ ਗਾਣਾ ਸੁਣਦਾ ਗਾਣੇ ਸੁਣਦਾ ਏ ਉਹ ਇਹਨਾਂ ਗੀਤਾਂ ਨੂੰ ਵੀ ਸੁਣਦਾ ਜਿਹੜੇ ਮਤ ਮਤਲਬ ਕਿ ਜ਼ਿਆਦਾ ਬੰਦੂਕਾਂ 'ਤੇ ਗੋਲੀਆਂ 'ਤੇ ਹੁੰਦੇ ਹੈ ਅਤੇ ਉਹ ਉਹੀ ਚੀਜ਼ ਆਪਣੇ ਫਿਰ ਆਪਣੀ ਜ਼ਿੰਦਗੀ 'ਤੇ ਅਪਣਾਉਣ ਦੀ ਕੋਸ਼ਿਸ਼ ਕਰਦਾ ਜਿਸਦੇ ਨਾਲ ਕੀ ਹੁੰਦਾ ਵੀ ਸਾਡੀ ਜਿਹੜੀ ਜਵਾਨੀ ਹੈ ਉਹ ਇਹਨਾਂ ਚੀਜ਼ਾਂ ਵੱਲ ਨੂੰ ਹੋ ਤੁਰਦੀ ਹੈ ਅਤੇ ਆਪਣਾ ਆਪਣੀ ਜਵਾਨੀ ਅਤੇ ਆਪਣਾ ਸਮਾਂ ਬਰਬਾਦ ਕਰਦੀ ਹੈ ਅਤੇ ਇਹ ਨਸ਼ਿਆਂ 'ਤੇ ਵੀ ਬਹੁਤ ਜ਼ਿਆਦਾ ਮਤਲਬ ਕਿ ਗਾਉਂਦੇ ਹੈ ਠੀਕ ਹੈ ਟੀਕੇ ਲਾਉਂਦੇ ਦਿਖਾਉਂਦੇ ਹੈ ਫਿਰ ਉਹ ਜਿਹੀਆਂ ਹੀ ਵੀਡੀਓਜ਼ ਬਣਾਉਂਦੇ ਆ ਜਿਸ ਨਾਲ ਸਾਡਾ ਸਮਾਜ ਅਤੇ ਸਾਡੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਨਹੀਂ ਸੁਰੱਖਿਅਤ ਹੁੰਦੀਆਂ ਸਾਡਾ ਸਮਾਜ ਵੀ ਸਮਾਜ ਦਾ ਵਾਤਾਵਰਨ ਬਹੁਤ ਜ਼ਿਆਦਾ ਖਰਾਬ ਹੁੰਦਾ ਏ ਅਤੇ ਗੈਂਗਸਟਰਵਾਦ ਹੈ ਜਿਹੜਾ ਉਹ ਬਹੁਤ ਜ਼ਿਆਦਾ ਵੱਧਦਾ ਏ ਅਤੇ ਇਸ ਲਈ ਸਾਨੂੰ ਚਾਹੀਦਾ ਵੀ ਇਹ ਜਿਹੇ ਗਾਇਕਾਂ ਦਾ ਬਾਈਕਾਟ ਕੀਤਾ ਜਾਵੇ ਅਤੇ ਚੰਗੀ ਗਾਇਕੀ ਗਾਈ ਜਾਵੇ